ਭਾਰਤ ਵੱਖ ਵੱਖ ਧਰਮਾਂ ਦਾ ਦੇਸ਼ ਹੈ ਧਾਰਮਿਕ ਰੀਤੀ ਰਿਵਾਜ਼ ਦਾ ਭਾਰਤ ਦੇ ਹਰੇਕ ਖਿ ਖਿੱਤੇ ਵਿੱਚ ਆਪਣਾ ਹੀ ਮਹੱਤਵ ਹੈ ਹਿੰਦੂ ਸਮਾਜ ਵਿੱਚ ਮੱਥੇ 'ਤੇ ਸੰਧੂਰ ਲਗਾਉਣ ਦਾ ਆਪਣਾ ਮਹੱਤਵ ਹੈ ਹਰ ਵਿਹੁਤਾ ਔਰਤ ਹਰੇਕ ਤਿਉਹਾਰ ਦੇ ਉੱਤੇ ਆਪਣੇ ਆਪ ਨੂੰ ਮੱਥੇ 'ਤੇ ਸੰਧੂਰ ਲਗਾ ਕੇ ਪਤੀ ਵਰਤਾ ਹੋਣ ਦਾ ਪ੍ਰਮਾਣ ਦਿੰਦੀ ਹੈ ਸੂਰਜ ਨੂੰ ਪਾਣੀ ਚੜ੍ਹਾਉਣਾ ਵੀ ਹਿੰਦੂ ਧਰਮ ਵਿੱਚ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਹਿੰਦੂ ਧਰਮ ਵਿੱਚ ਸੂਰਜ ਨੂੰ ਪ੍ਰਮੁੱਖ ਦੇਵਤਿਆਂ ਵਿੱਚੋਂ ਮੰਨਿਆ ਜਾਂਦਾ ਹੈ ਇਹ ਵੀ ਇੱਕ ਤਰ੍ਹਾਂ ਨਾਲ ਸੂਰਜ ਨੂੰ ਨਮਸਕਾਰ ਕੀਤੀ ਜਾਂਦੀ ਹੈ ਹਿੰਦੂ ਵੱਖ ਵੱਖ ਧਾਰਮਿਕ ਅਸਥਾਨਾਂ 'ਤੇ ਜਾ ਕੇ ਸੂਰਜ ਦੇਵਤਾ ਨੂੰ ਪਾਣੀ ਚੜ੍ਹਾਉਂਦੇ ਅਕਸਰ ਦੇਖੇ ਜਾਂਦੇ ਹਨ ਸਿੱਖ ਧਰਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਜਾਂਦਾ ਹੈ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਜਾਂਦਾ ਹੈ ਇਸ ਦਾ ਮਨੋਰਥ ਜਾਤ ਪਾਤ ਨੂੰ ਦੂਰ ਕਰਨਾ ਹੈ ਦਰਅਸਲ ਵਿੱਚ ਸਿੱਖ ਧਰਮ ਵਿੱਚ ਕੁੱਲ ਲੁਕਾਈ ਨੂੰ ਇੱਕ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਮੁਸਲਮਾਨ ਲੋਕ ਦਰਗਾਹ 'ਤੇ ਚਾਦਰਾਂ ਚੜ੍ਹਾਉਂਦੇ ਹਨ ਅਤੇ ਹਜਰਤ ਮੁਹੰਮਦ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ ਮੁਸਲਮਾਨ ਸਮਾਜ ਵਿੱਚ ਵਰਤ ਅਤੇ ਰੋਜ਼ੇ ਰੱਖਣਾ ਵੀ ਅਹਿਮ ਮੰਨਿਆ ਜਾਂਦਾ ਹੈ ਧਾਰਮਿਕ ਰੀਤੀ ਰਿਵਾਜ਼ਾਂ ਦਾ ਸਾਡੇ ਸੱਭਿਆਚਾਰ ਨੂੰ ਹੋਰ ਅਮੀਰੀ ਬਖਸ਼ਣਾ ਅਤੇ ਭਾਈਸਾਰ ਭਾਈਚਾਰਕ ਸਾਂਝ ਨੂੰ ਹੋਰ ਪਕੇਰਾ ਕਰਨ ਦਾ ਬਲ ਬਖਸ਼ਦੇ ਹਨ